ਦੇਸੀ ਪੌਦੇ ਵੱਖ ਵੱਖ ਤਰੀਕੇ ਦੇ ਹੁੰਦੇ ਹਨ ਸਭ ਤੋਂ ਆਮ ਜਿਹੜਾ ਹਰ ਘਰ 'ਚ ਮਿਲਦਾ ਹੈ ਉਹ ਹੁੰਦਾ ਹੈ ਨਿੰਮ ਦਾ ਕਿਉਂਕਿ ਨਿੰਮ ਦੇ ਆਪਣੇ ਬਹੁਤ ਜ਼ਿਆਦਾ ਲਾਭ ਹੁੰਦੇ ਹਨ ਜਿੰਨ੍ਹਾਂ ਦੇ ਫੋੜੇ ਫਿਨਸੀਆਂ ਹੁੰਦੇ ਉਹ ਵੀ ਕਈ ਵਾਰੀ ਨਿੰਮ ਦੇ ਪੇੜ ਦੀ ਵਰਤੋਂ ਕਰਦੇ ਹਾਂ ਕਈ ਵਾਰੀ ਜਦੋਂ ਕਿਸੇ ਕਾੜਾ ਵਗੈਰਾ ਬਣਾਉਣ ਵਾਸਤੇ ਵੀ ਨਿੰਮ ਦੇ ਪੇੜਾਂ ਦੀ ਵਰਤੋਂ ਹੁੰਦੀ ਹੈ ਅਤੇ ਜਦੋਂ ਆਪਾਂ ਕਈ ਵਾਰੀ ਇਹਨਾਂ ਦੀ ਦੇਖਭਾਲ ਕਰਨੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਕੋਈ ਜਿਹੜਾ ਬਾਗ ਹੁੰਦਾ ਉੱਧਰੋਂ ਖਰੀਦ ਕੇ ਲਿਆ ਜਾਂਦਾ ਹੈ ਅਤੇ ਇਹਨਾਂ ਦੀ ਢੰਗ ਨਾਲ ਸਾਨੂੰ ਜਿਹੜੀ ਆ ਇਹਨਾਂ ਦੀ ਕੇਅਰ ਕਰਨੀ ਚਾਹੀਦੀ ਆ ਅਤੇ ਉਹਦੇ ਵਾਸਤੇ ਸਾਨੂੰ ਦੇਖਣਾ ਹੁੰਦਾ ਕਿ ਇਹਨਾਂ ਨੂੰ ਟਾਈਮ ਸਿਰ ਪਾਣੀ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਇਹਨਾਂ ਨੂੰ ਅ ਟਾਈਮ ਟਾਈਮ 'ਤੇ ਖਾਦ ਪਾ ਰਿਹਾ ਕਿ ਨਹੀਂ ਪਾ ਰਹੇ ਅਤੇ ਜ਼ਿਆਦਾ ਦੇਰ ਧੁੱਪੇ ਤਾਂ ਨਹੀਂ ਹੈਗੇ ਆ ਥੋੜ੍ਹੀ ਜਿਹੀ ਛਾਂ ਵੀ ਮਿਲੇ ਇਹਨਾਂ ਨੂੰ ਅਤੇ ਇਹ ਥੋੜ੍ਹੀਆਂ ਥੋੜ੍ਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਦੈਟ ਜਿਹੜਾ ਸਾਡਾ ਪੌਦਾ ਆ ਉਹ ਵਧੀਆ ਤਰੀਕੇ ਨਾਲ ਗਰੋ ਕਰੇ ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਦੇਸੀ ਪੌਦੇ ਆ ਜਿਵੇਂ ਕਿ ਨਿੰਮ ਹੀ ਹੋ ਗਿਆ ਉਹਨਾਂ ਨੂੰ ਸਾਨੂੰ ਆਪਣੇ ਘਰ 'ਚ ਲਾਉਣਾ ਹੀ ਚਾਹੀਦਾ ਕਿਉਂਕਿ ਇਹਨਾਂ ਦੇ ਆਪਣੇ ਵੀ ਬੈਨੀਫਿਟਸ ਬਹੁਤ ਹੁੰਦੇ ਹਨ